ਹਾਂਜੀ ਇਹੋ ਜਿਹੀ ਕਿਤਾਬ ਹੈ ਜਿਵੇਂ ਕਿ ਰਵਿੰਦਰ ਨਾਥ ਟੈਗੋਰ ਦੀ ਪੀ ਬੁੱਕ ਹੋ ਗਈ ਗੀਤਾਂਜਲੀ ਬੁੱਕ ਜੋ ਕਿ ਬੜੀ ਹੀ ਜ਼ਿਆਦਾ ਫੇਮਸ ਹੈ ਅਤੇ ਉਹ ਸਟਾਰਟਿੰਗ ਵਿੱਚ ਮੈਨੂੰ ਲੱਗਿਆ ਸੀ ਕਿ ਇੰਨੀ ਚੰਗੀ ਨਹੀਂ ਹੋਵੇਗੀ ਬਟ ਜਦੋਂ ਮੈਂ ਉਹਨੂੰ ਪੜ੍ਹਨਾ ਸ਼ੁਰੂ ਕੀਤਾ ਤਾਂ ਮੇਰਾ ਇੰਟਰਸਟ ਉਹਦੇ ਵਿੱਚ ਆਪਣੇ ਆਪ ਹੀ ਵੱਧਦਾ ਗਿਆ ਅਤੇ ਉਹ ਬੁੱਕ ਹੈ ਵੀ ਬਹੁਤ ਵਧੀਆ ਅਤੇ ਉਹ ਬੁੱਕ ਪੜ੍ਹਨ ਵਾਲੀਆਂ ਹਨ ਰਵਿੰਦਰ ਨਾਥ ਟੈਗੋਰ ਦੀਆਂ ਸਾਰੀਆਂ ਕਿਤਾਬਾਂ ਬਹੁਤ ਹੀ ਵਧੀਆ ਹਨ ਅਤੇ ਸਾਰਿਆਂ ਨੂੰ ਉਹ ਬੁੱਕਾਂ ਪੜ੍ਹਨੀਆਂ ਚਾਹੀਦੀਆਂ ਹਨ ਉਹਦੇ ਵਿੱਚ ਸਾਨੂੰ ਬਹੁਤ ਹੀ ਜ਼ਿਆਦਾ ਗਿਆਨ ਅਤੇ ਬਹੁਤ ਹੀ ਜ਼ਿਆਦਾ ਮੋਟੀਵੇਸ਼ਨ ਮਿਲਦੀ ਹੈ ਕਿ ਸਾਨੂੰ ਅੱਗੇ ਕੀ ਕਰਨਾ ਚਾਹੀਦਾ ਹੈ ਜਿੰਦਗੀ ਵਿੱਚ ਅਤੇ ਉਹ ਬੁੱਕ ਮੈਨੂੰ ਬਹੁਤ ਹੀ ਪਸੰਦ ਆਈ ਸੀ